ਮੋਹਾਲੀ ਜ਼ਿਲ੍ਹੇ ਵਿੱਚ ਅਲੱਗ ਅਲੱਗ ਧਰਮਾਂ ਦੇ ਲੋਕ ਰਹਿਣ ਕਾਰਨ ਉਹਨਾਂ ਦੇ ਅਲੱਗ ਅਲੱਗ ਹੀ ਸੱਭਿਆਚਾਰ ਹਨ ਅਤੇ ਹਰ ਇੱਕ ਧਰਮ ਦੇ ਲੋਕ ਆਪਣੇ ਸੱਭਿਆਚਾਰ ਆਪਣਾ ਆਪੋ ਆਪਣੇ ਤਰੀਕੇ ਨਾਲ ਮਨਾਉਂਦੇ ਹਨ ਅਤੇ ਪਿਆਰ ਅਤੇ ਸੱਭਿਆਚਾਰ ਹੋਣ ਕਾਰਨ ਹਰ ਇੱਕ ਧਰਮਾਂ ਦੇ ਲੋਕ ਹਰ ਇੱਕ ਦੇ ਸੱਭਿਆਚਾਰ ਨੂੰ ਬੜੇ ਹੀ ਪਿਆਰ ਨਾਲ ਅਤੇ ਆਪਣਾ ਉਤਸ਼ਾਹ ਦਿਖਾ ਕੇ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਮੋਹਾਲੀ ਜ਼ਿਲ੍ਹਾ ਪੰਜਾਬ ਵਿੱਚ ਹੋਣ ਕਰਕੇ ਇੱਥੇ ਪੰਜਾਬੀ ਸੱਭਿਆਚਾਰ ਜ਼ਿਆਦਾ ਮਨਾਏ ਜਾਂਦੇ ਹਨ ਪਰ ਪੰਜਾਬੀ ਸੱਭਿਆਚਾਰ ਦੇ ਮਨਾਉਣ ਦੇ ਨਾਲ ਨਾਲ ਉਹਨਾਂ ਵਿੱਚ ਜਿੰਨੇ ਵੀ ਧਰਮਾਂ ਦੇ ਸੱਭਿਆਚਾਰ ਹਨ ਉਹਨਾਂ ਨੂੰ ਬਰਾਬਰ ਸਨਮਾਨਤਾ ਦਿੱਤੀ ਜਾਂਦੀ ਹੈ ਉਹਨਾਂ ਦੇ ਆਪੋ ਆਪਣੇ ਤਿਉਹਾਰ ਹਨ ਅਤੇ ਆਪੋ ਆਪਣੇ ਸੱਭਿਆਚਾਰ